ਰਸੋਈ ਜਿਹੜੀ ਆ ਰਸੋਈ ਤਾਂ ਹੀ ਹੋਏਗੀ ਜੇ ਰਸੋਈ ਦੇ ਵਿੱਚ ਕੁਛ ਭਾਂਡੇ ਹੋਣਗੇ ਭਾਂਡਿਆਂ ਦੇ ਬਿਨਾ ਜਿਹੜੀ ਰਸੋਈ ਆ ਉਹ ਅਧੂਰੀ ਹੈ ਰਸੋਈ ਦੇ ਵਿੱਚ ਜਿਹੜੇ ਹੈਗੇ ਨੇ ਮੁੱਖ ਭਾਂਡੇ ਆਪਣਾ ਸਭ ਤੋਂ ਪਹਿਲਾਂ ਤਾਂ ਭਾਂਡਿਆਂ ਤੋਂ ਇਲਾਵਾ ਜਿਹੜਾ ਹੈਗਾ ਗੈਸ ਚੁੱਲ੍ਹਾ ਹੋਏਗਾ ਉਹਦੇ ਨਾਲ ਕੁਛ ਭਾਂਡੇ ਹੋਣਗੇ ਜਿਹਦੇ ਵਿੱਚ ਆਪਾਂ ਸਰਵ ਕਰਾਂਗੇ ਆਪਣੇ ਭੋਜਨ ਨੂੰ ਪਕਵਾਨ ਨੂੰ ਸਰਵ ਕੀਤਾ ਜਾਵੇਗਾ ਖਾਣ ਦੇ ਲਈ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਆ ਕੌਲੀ ਪਲੇਟ ਚਮਚੇ ਜਿਹੜੀ ਹੈਗੇ ਆ ਮੇਨ ਆ ਜਾਂਦੇ ਨੇ ਗਲਾਸ ਆ ਜਾਂਦਾ ਜਿਹੜਾ ਗਲਾਸ ਦੀ ਵਰਤੋਂ ਆ ਉਹ ਦੁੱਧ ਪਾਣੀ ਚਾਹ ਪੀਣ ਦੇ ਲਈ ਕੀਤੀ ਜਾਂਦੀ ਆ ਜਿਹੜਾ ਆਪਣਾ ਕੌਲੀਆਂ ਨੇ ਉਹਦੇ ਵਿੱਚ ਕੁਛ ਖਾ ਕੇ ਪਾ ਪਾ ਕੇ ਖਾਣ ਲਈ ਕੀਤਾ ਜਿਵੇਂ ਦਾਲ ਹੋ ਗਈ ਦਹੀਂ ਹੋ ਗਈ ਜਾਂ ਕੁਛ ਹੋਰ ਜਿਹੜਾ ਹੈ ਲਿਕੁਅਡ ਟਾਈਪ ਜਾਂ ਸੈਮੀ ਲਿਕੁਅਡ ਚੀਜ਼ ਜਿਹੜੀ ਹੈਗੀ ਆ ਉਹ ਖਾਣ ਲਈ ਕੀਤੀ ਜਾਂਦੀ ਆ ਪਲੇਟਾਂ ਦੇ ਵਿੱਚ ਆਪਾਂ ਕੁਛ ਰੱਖਦੇ ਜਿਵੇਂ ਰੋਟੀ ਹੋ ਗਿਆ ਸਲਾਦ ਹੋ ਗਿਆ ਉਹ ਰੱਖਿਆ ਜਾਂਦਾ ਥਾਲੀ ਪਲੇਟ ਦੇ ਵਿੱਚ ਚਮਚੇ ਦੀ ਵਰਤੋਂ ਜਿਹੜੀ ਹੈਗੀ ਆ ਉਹ ਰੋਟੀ ਖਾਣ ਦੇ ਸਮੇਂ ਜਾਂ ਕੋਈ ਚੀਜ਼ ਨੂੰ ਖਾਣ ਲਈ ਕੀਤੀ ਜਾਂਦੀ ਆ ਅਤੇ ਇਸ ਤਰੀਕੇ ਨਾਲ ਮੁੱਖ ਬਰਤਨਾਂ ਦੇ ਵਿੱਚ ਹੀ ਆ ਜਾਂਦੇ ਇਸ ਤੋਂ ਇਲਾਵਾ ਰਸੋਈ ਦੇ ਵਿੱਚ ਆਪਣੇ ਫਰਾਈਪੈਨ ਹੈ ਜਾਂ ਕੜਾਹੀਆਂ ਨੇ ਜਿਹੜੀ ਸਬਜ਼ੀ ਬਣਾਉਣ ਦੇ ਲਈ ਵਰਤੇ ਜਾਂਦੇ ਨੇ ਤਵਾ ਹੈ ਰੋਟੀ ਬਣਾਉਣ ਦੇ ਲਈ ਵਰਤਿਆ ਜਾਂਦਾ ਹੈਗਾ ਅਤੇ ਆਪਣੀ ਚਾਹ ਵਾਸਤੇ ਜਿਹੜੀ ਹੈਗੀ ਆਪਣੀ ਡੋਂਗਾ ਆਪਣੇ ਸੋਰੀ ਡੋਂਗਾ ਆ ਗਿਆ ਜਾਂ ਕੁਛ ਇੱਦਾਂ ਦਾ ਆ ਗਏ ਨੇ ਅਤੇ ਇਹ ਬਰਤਨ ਜਿਹੜੇ ਹੈਗੇ ਨੇ ਵਰਤੇ ਜਾਂਦੇ ਨੇ